ਮੈਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਂਕ ਹੈ ਮੈਂ ਆਪਣੀ ਪੇਂਟਿੰਗ ਕਰਨ ਲਈ ਗੈਰ ਰਵਾਇਤੀ ਸਮੱਗਰੀ ਦੀ ਵਰਤੋਂ ਵੀ ਕੀਤੀ ਹੈ ਉਦਾਹਰਣ ਵਜੋਂ ਮੈਂ ਆਪਣੀਆਂ ਉਂਗਲੀਆਂ ਦੇ ਪੋਟਿਆਂ ਉੱਪਰ ਅਤੇ ਅੰਗੂਠੇ ਨੂੰ ਰੰਗ ਲਗਾ ਕੇ ਬਹੁਤ ਹੀ ਖੂਬਸੂਰਤ ਅਤੇ ਅਲੱਗ ਪੇਂਟਿੰਗ ਬਣਾਈ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਈ ਇਸ ਤੋਂ ਇਲਾਵਾ ਭਿੰਡੀਆਂ ਨੂੰ ਕੱਟ ਕੇ ਅਤੇ ਕਰੇਲਿਆਂ ਨੂੰ ਕੱਢ ਕੇ ਰੰਗਾਂ ਵਿੱਚ ਡੁੱਬੋ ਕੇ ਅਲੱਗ ਅਲੱਗ ਆਕਰਤੀਆਂ ਬਣਾਈਆਂ ਕਰੇਲੇ ਨੂੰ ਕੱਟ ਕੇ ਮੈਂ ਫੁੱਲਾਂ ਦੀ ਆਕ੍ਰਿਤੀ ਬਣਾਈ ਜੋ ਕਿ ਲੋਕਾਂ ਨੂੰ ਬਹੁਤ ਹੀ ਜਿਆਦਾ ਪਸੰਦ ਆਈ ਇਸ ਨਾਲ ਮੇਰੀ ਕਲਾ ਦੀ ਬਹੁਤ ਪ੍ਰਸਿੱਧੀ ਹੋਈ ਅਤੇ ਇਸ ਦੇ ਨਤੀਜੇ ਵਜੋਂ ਮੇਰੀ ਵਿਕਰੀ ਮੇਰੀ ਪੇਂਟਿੰਗ ਦੀ ਵਿਕਰੀ ਬਹੁਤ ਹੀ ਜਿਆਦਾ ਹੋਈ ਅਤੇ ਮੈਨੂੰ ਬਹੁਤ ਪ੍ਰਸੰਨਤਾ ਹੈ